ਹਾਂਜੀ ਜੀ ਹਾਂ ਸਾਡੇ ਬਹੁਤ ਸਾਰੇ ਤਿਉਹਾਰ ਵੀ ਆ ਸਮਾਗਮ ਹੁੰਦੇ ਆ ਜਦੋਂ ਡਾਂਸ ਗਿੱਧਾ ਭੰਗੜਾ ਪਾਇਆ ਜਾਂਦਾ ਹੈ ਜਿਸ ਤਰ੍ਹਾਂ ਹੁਣ ਸਾਡੇ ਪਿੰਡ ਵਿੱਚ ਕੋਈ ਵਿਆਹ ਹੋਵੇ ਉਦੋਂ ਵਿਆਹ ਸਮੇਂ ਵੀ ਬਹੁਤ ਸਾਰੇ ਡਾਂਸ ਗਾਣਾ ਗਿੱਧਾ ਪਾਇਆ ਜਾਂਦਾ ਹੈ ਹੁਣ ਸਾਡੇ ਪਿੰਡ ਵਿਆਹ ਸੀਗਾ ਮੁੰਡੇ ਦਾ ਉਹਦੇ ਵਿਆਹ ਵਾਲੇ ਦਿਨ ਵੀ ਬਹੁਤ ਸਾਰਾ ਡਾਂਸ ਕੀਤਾ ਗਿਆ ਭੰਗੜਾ ਪਾਇਆ ਗਿਆ ਵਿਆਹ ਤੋਂ ਪਹਿਲਾਂ ਵੀ ਉੱਥੇ ਗਾਉਣ ਬਿਠਾਇਆ ਗਿਆ ਗਾਉਣ ਸਮੇਂ ਵੀ ਸਾਰਿਆਂ ਨੇ ਰਲ ਕੇ ਕੁੜੀਆਂ ਮੁੰਡਿਆਂ ਨੇ ਮਾਤਾਵਾਂ ਨੇ ਸਾਰਿਆਂ ਨੇ ਰਲ ਮਿਲ ਕੇ ਗਿੱਧਾ ਪਾਇਆ ਭੰਗੜਾ ਪਾਇਆ ਫਿਰ ਸੁਹਾਗ ਬੋਲੇ ਗਏ ਘੋੜੀਆਂ ਬੋਲੀਆਂ ਜਾਂਦੀਆਂ ਨੇ ਸਾਰੇ ਮਿਲ ਕੇ ਬਹੁਤ ਖੁਸ਼ੀ ਨਾਲ ਮਨਾਇਆ ਜਾਂਦਾ ਇਹ ਤਿਉਹਾਰ ਮਤ ਗਿੱਧਾ ਗਾਣਾ ਜੋ ਵੀ ਡਾਂਸ ਆ ਬਹੁਤ ਸਾਰਾ ਰਲ ਮਿਲ ਕੇ ਕਰਦੇ ਨੇ ਜਦੋਂ ਸਾਡੇ ਬੇਟਾ ਬੇਟੀ ਬੱਚਾ ਜਦੋਂ ਵੀ ਹੁੰਦਾ ਉਹਦੀ ਵੀ ਖੁਸ਼ੀ ਮਨਾਈ ਜਾਂਦੀ ਨਵੇਂ ਬੱਚੇ ਦੇ ਆਉਣ ਦੇ ਵਿੱਚ ਵੀ ਉਦੋਂ ਵੀ ਭੰਗੜਾ ਪਾਇਆ ਜਾਂਦਾ ਢੋਲੀ ਨੂੰ ਬੁਲਾਇਆ ਜਾਂਦਾ ਵਾ ਗਾਣੇ ਬੋਲ ਬੋਲ ਕੇ ਡਾਂਸ ਕੀਤਾ ਜਾਂਦਾ ਵਾ ਬਹੁਤ ਖੁਸ਼ੀ ਮਨਾਈ ਜਾਂਦੀ ਆ ਆਪਣੀ ਖੁਸ਼ੀ ਜ਼ਾਹਿਰ ਕੀਤੀ ਜਾਂਦੀ ਹੈ ਇੱਕ ਭੰਗੜੇ ਡਾਂਸ ਰਾਹੀਂ ਆਪਣੇ ਮਨ ਦੀ ਖੁਸ਼ੀ ਜਿਹੜੀ ਆ ਉਹ ਜ਼ਾਹਿਰ ਹੋ ਜਾਂਦੀ ਆ ਬਹੁਤ ਖੁਸ਼ੀ ਮਨਾਈ ਜਾਂਦੀ ਹੈ ਅਤੇ ਸਾਡੇ ਪਿੰਡ ਵਿੱਚ ਇੱਕ ਮੇਲਾ ਵੀ ਲੱਗਦਾ ਵਾ ਉੱਥੇ ਗਾਉਣ ਵਾਲੀ ਬੁਲਾਈ ਜਾਂਦੀ ਹੈ ਉੱਥੇ ਗਾਉਣ ਵਾਲੀ ਗਾਣੇ ਬੋਲਦੀ ਡਾਂਸਰਾਂ ਬੁਲਾਈਆ ਜਾਂਦੀਆਂ ਨੇ ਉਹ ਡਾਂਸ ਕਰਦੀਆਂ ਨੇ ਲੋਕ ਚਲੋ ਇਕੱਠ ਇਕੱਠਾ ਹੋ ਕੇ ਉਹਨਾਂ ਨੂੰ ਵੇਖਦਾ ਹੈ ਸਾਉਣ ਵਿੱਚ ਤੀਆਂ ਲੱਗਦੀਆਂ ਨੇ ਸਾਡੇ ਪਿੰਡ ਇੱਕ ਬੋਹੜ ਆ ਉੱਥੇ ਪੀਂਘ ਪਾਈ ਹੋਈ ਆ ਉਥੇ ਸਾਰੀਆਂ ਸਾਉਣ ਵਾਲੇ ਦਿਨ ਧੀਆਂ ਸਾਉਣ ਜਦੋਂ ਅਸੀਂ ਮਨਾਉਂਦੇ ਹਾਂ ਅਤੇ ਸਾਰੀਆਂ ਧੀਆਂ ਇਕੱਠੀਆਂ ਹੋ ਕੇ ਆਉਦੀਆਂ ਨੇ ਆਣ ਕੇ ਉਥੇ ਨੱਚਦੀਆਂ ਟੱਪਦੀਆਂ ਗਿੱਧਾ ਪਾਉਂਦੀਆਂ ਨੇ ਫਿਰ ਉੱਥੇ ਜਦੋਂ ਜਿਹੜੀਆਂ ਵਿਆਹੀਆਂ ਹੁੰਦੀਆਂ ਨੇ ਉਹ ਵੀ ਸੋਹਰਿਆਂ ਤੋਂ ਆਣ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੀਆਂ ਨੇ ਨੱਚਦੀਆਂ ਟੱਪਦੀਆਂ ਡਾਂਸ ਕਰਦੀਆਂ ਗਿੱਧੇ ਭੰਗੜੇ ਪਾਉਂਦੀਆਂ ਵਿਸਾਖੀ ਸਮੇਂ ਵੀ ਇੱਥੇ ਵਿਸਾਖੀ 'ਤੇ ਵੀ ਮੁੰਡੇ ਢੋਲੀ ਢੋਲ ਲਿਆ ਕੇ ਵਜਾਉਂਦੇ ਨੇ ਅਤੇ ਭੰਗੜਾ ਪਾਉਂਦੇ ਨੇ ਅਤੇ ਵਿਸਾਖੀ ਵੀ ਮਨਾਉਂਦੇ ਨੇ